ਹਾਂਜੀ ਅਸੀਂ ਖ਼ਬਰਾਂ ਤਾਂ ਜ਼ਰੂਰ ਸੁਣਦੇ ਹਾਂ ਅਸੀਂ ਟੀ ਵੀ 'ਤੇ ਸੁਣਦੇ ਹਾਂ ਅੱਠ ਵਾਲੀਆਂ ਸੁਣਦੇ ਹਾਂ ਸਾਢੇ ਛੇ ਵਾਲੀਆਂ ਸੁਣਦੇ ਹਾਂ ਪੰਜਾਬੀ ਖ਼ਬਰਾਂ ਜਲੰਧਰ ਤੋਂ ਸੁਣਦੇ ਹਾਂ ਜੀ ਮੋਮੈਲ ਤਾਂ ਮੈਨੂੰ ਚਲਾਉਣਾ ਨਹੀਂ ਆਉਂਦਾ ਮੋਮੈਲ ਦੇ ਨਾ ਮੈਂ ਕਦੇ ਸੁਣੀਆਂ ਨਹੀਂ ਮੇਰਾ ਤਾਂ ਸਾਦਾ ਜਿਹਾ ਮੋਬੈਲ ਆ ਮੈਂ ਟੀ ਵੀ 'ਤੇ ਖ਼ਬਰਾਂ ਸੁਣਦੀ ਹਾਂ ਹੋਰ ਸੁਣ ਲਿਆ ਪੰਜਾਬੀ ਸਾ ਸੱਭਿਆਚਾਰ ਪ੍ਰੋਗਰਾਮ ਹੁੰਦੇ ਆ ਜਿਹੜੇ ਉਹ ਵੀ ਸੁਣ ਲੈਂਦੀ ਹਾਂ ਉਹ ਵੀ ਦੇਖਦੇ ਹੈ ਅਤੇ ਖ਼ਬਰਾਂ ਵੀ ਦੇਖਦੇ ਹਾਂ ਸੁਣਦੇ ਵੀ ਹੈ ਸਾਰਾ ਕੁਛ ਕੀ ਹੁੰਦਾ ਇੰਡੀਆ 'ਚ ਕੀ ਨਹੀਂ ਹੁੰਦਾ ਪਤਾ ਲੱਗ ਜਾਂਦਾ ਜੀ ਪੰਜਾਬੀ ਖ਼ਬਰਾਂ ਸੁਣ ਕੇ ਅਖ਼ਬਾਰ ਵੀ ਪੜ੍ਹ ਲਈਦਾ ਜੀ ਉਹਦੇ 'ਚ ਵੀ ਪਤਾ ਲੱਗ ਜਾਂਦਾ ਅਖ਼ਬਾਰ ਜਿਹੜਾ ਕੋਈ ਵੀ ਹੋਵੇ ਪੰਜਾਬੀ ਉਹ ਸਾਰੇ ਅਖ਼ਬਾਰ ਦੋਨੋ ਤਿੰਨੇ ਸਾਰੇ ਪੜ੍ਹ ਲਈਦੇ